ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਹਿੰਦੀ ਤਾਮਿਲ ਗੁਜਰਾਤੀ ਸਿੰਧੀ ਪੰਜਾਬੀ ਉਰਦੂ ਆਦਿ ਬਾਈ ਭਾਸ਼ਾਵਾਂ ਹਨ ਜੋ ਕਿ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ ਇਸ ਤੋਂ ਇਲਾਵਾ ਅਲੱਗ ਅਲੱਗ ਸਟੇਟਾਂ ਦੇ ਵਿੱਚ ਬੋਲੀਆਂ ਜਾਣ ਵਾਲੀਆਂ ਹੋਰ ਭਾਸ਼ਾਵਾਂ ਵੀ ਹਨ ਜਿਵੇਂ ਕਿ ਹਿਮਾਚਲ ਅਤੇ ਜੰਮੂ ਵਿੱਚ ਜਾਓ ਉੱਥੇ ਡੋਗਰੀ ਭਾਸ਼ਾ ਆਮ ਚੱਲਦੀ ਹੈ ਦੇਸ਼ ਦੀ ਭਾਸ਼ਾਈ ਭਿੰਨਤਾ ਬਾਰੇ ਅਸੀਂ ਇਹ ਸੋਚਦੇ ਹਾਂ ਕਿ ਦੇਸ਼ ਦੀ ਜਿਹੜੀ ਭਾਸ਼ਾ ਹੈ ਉਹ ਇੱਕ ਹੋਣੀ ਚਾਹੀਦੀ ਹੈ ਜਿਵੇਂ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ ਅਲੱਗ ਅਲੱਗ ਭਾਸ਼ਾਵਾਂ ਦੇ ਸੁਮੇਲ ਦੇ ਨਾਲ ਭਾਸ਼ਾ ਜਿਹੜੀ ਹੈਗੀ ਹੈ ਉਹ ਭਿੰਨ ਭਿੰਨ ਬਣ ਜਾਂਦੀ ਹੈ ਇਸ ਲਈ ਚੰਗਾ ਹੈ ਕਿ ਇਕੋ ਜਿਹਾ ਰੂਪ ਦਿੱਤਾ ਜਾਵੇ ਤਾਂ ਕਿ ਇੱਕ ਦੇਸ਼ ਦੀ ਰਾ ਇੱਕ ਦੇਸ਼ ਦੀ ਕਲਪਨਾ ਕੀਤੀ ਜਾ ਸਕੇ